ਸਾਡੇ ਖੇਤਰ ਦੇ ਵਿੱਚ ਰਵਾਇਤੀ ਖੇਡਾਂ ਬਹੁਤ ਸਾਰੀਆਂ ਜਿਨ੍ਹਾਂ ਦੇ ਵਿੱਚ ਗੁੱਲੀ ਡੰਡਾ ਕੋਟਲੀ ਛਪਾ ਕੋਟਲਾ ਛਪਾਕੀ ਔਰ ਗੋਲੇ ਖੇਡਣੇ ਬਾਂਟੇ ਖੇਡਣੇ ਜਿਹਨਾਂ ਨੂੰ ਕਹਿੰਦੇ ਹਾਂ ਹਾਕੀ ਖੇਡਦੇ ਹਾਂ ਅਸੀਂ ਹੈ ਫੁੱਟਬਾਲ ਵੀ ਖੇਡ ਲੈਂਦੇ ਹਾਂ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਰਵਾਇਤੀ ਖੇਡਾਂ ਜਿਨ੍ਹਾਂ ਦੇ ਵਿੱਚ ਅਸੀਂ ਅੱਡੀ ਟੱਪਾ ਜਿਹਨੂੰ ਅਸੀਂ ਅੱਡਾ ਖੱਡਾ ਕਹਿੰਦੇ ਹਾਂ ਉਹ ਵੀ ਹੈ ਅਤੇ ਦੂਸਰੇ ਪਾਸੇ ਆਪਣੇ ਰੱਸੀ ਟੱਪਣਾ ਉਹ ਵੀ ਸਾਡੀਆਂ ਰਵਾਇਤੀ ਖੇਡਾਂ ਆਂ ਅਸੀਂ ਇਹਨਾਂ ਨੂੰ ਭੁੱਲੇ ਨਹੀਂ ਹਾਂ ਬੜੇ ਖੁਸ਼ੀ ਦੇ ਨਾਲ਼ ਖੇਡਦੇ ਹਾਂ